ਸਾਡੇ ਇਲਾਕੇ ਅੰਮ੍ਰਿਤਸਰ ਦੇ ਵਿੱਚ ਬਹੁਤ ਹੀ ਯਾਤਰਾ ਕਰਨ ਵਾਲੀਆਂ ਥਾਵਾਂ ਹਨ ਜਿੱਥੇ ਕਿ ਦੂਰੋਂ ਦੂਰੋਂ ਹਿੰਦੁਸਤਾਨ ਤੋਂ ਔਰ ਹਿੰਦੁਸਤਾਨ ਤੋਂ ਬਾਹਰੋਂ ਵੀ ਅੰਗਰੇਜ਼ ਲੋਕ ਆਪਣੇ ਆਪਣੇ ਮੁਲਕਾਂ ਤੋਂ ਇੱਥੇ ਆ ਕੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਸੈਰ ਕਰਦੇ ਹਨ ਜਿਨ੍ਹਾਂ ਦੇ ਵਿੱਚ ਪ੍ਰਮੁੱਖ ਹਨ ਸਾਡੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਔਰ ਉਸ ਤੋਂ ਬਾਅਦ ਸ਼੍ਰੀ ਦੁਰਗਿਆਣਾ ਤੀਰਥ ਰਾਮ ਤੀਰਥ ਔਰ ਇਸ ਤਰ੍ਹਾਂ ਹੀ ਗੋਬਿੰਦਗੜ੍ਹ ਫੋਰਟ ਔਰ ਇਸ ਤਰ੍ਹਾਂ ਹੀ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਕੰਪਨੀ ਬਾਗ ਜਿਹਨੂੰ ਕ ਰਾਮ ਬਾਗ ਵੀ ਕਿਹਾ ਜਾਂਦਾ ਉੱਥੇ ਮਹਾਰਾਜਾ ਰਣਜੀਤ ਸਿੰਘ ਦਾ ਸੰਬੰਧਿਤ ਬਹੁਤ ਸਾਰੀਆਂ ਬਾਗ ਬਹੁਤ ਵੱਡਾ ਔਰ ਉੱਥੇ ਉਹਨਾਂ ਦੀਆਂ ਦੇਖਣ ਯੋਗ ਥਾਵਾਂ ਹਨ ਇਸ ਤਰ੍ਹਾਂ ਹੀ ਸਾਡੇ ਅੰਮ੍ਰਿਤਸਰ ਦੇ ਵਿੱਚ ਵਾਹਗਾ ਬਾਰਡਰ ਜੋ ਕਿ ਪਾਕਿਸਤਾਨ ਨੂੰ ਅਟੈਚ ਕਰਦਾ ਹੈ ਉੱਥੇ ਵੀ ਦੀ ਪਰੇਡ ਵੇਖਣ ਵਾਸਤੇ ਬਹੁਤ ਸਾਰੇ ਲੋਕ ਸ਼ਾਮ ਨੂੰ ਦੇ ਦੇਖਣ ਜਾਂਦੇ ਹਨ ਇਸ ਤਰ੍ਹਾਂ ਹੀ ਸਾਡੇ ਅੰਮ੍ਰਿਤਸਰ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਯਾਤਰਾ ਕਰਨ ਵਾਲੀਆਂ ਛੋਟੀਆਂ ਵੱਡੀਆਂ ਥਾਵਾਂ ਹਨ ਹਿਸਟੋਰੀਕਲ ਗੁਰਦੁਆਰੇ ਹਨ ਅਤੇ ਘੁੰਮਣ ਫਿਰ ਵਾਸਤੇ ਬਹੁਤ ਸਾਰੇ ਪਾਰਕ ਹਨ